ਮੈਂ ਇੱਕ ਛੋਟਾ ਮੋਟਾ ਕਾਰੋਬਾਰੀ ਹਾਂ ਮੇਰਾ ਕਾਰੋਬਾਰ ਸਿਲਾਈ ਮਸ਼ੀਨ ਦੇ ਪੁਰਜੇ ਬਣਾਉਣ ਦਾ ਹੈ ਮੈਂ ਇਸ ਉਲਝਣ ਨੂੰ ਲੈ ਕੇ ਪਰੇਸ਼ਾਨ ਹੋ ਰਿਹਾ ਹਾਂ ਕਿ ਕੀ ਮੇਰਾ ਕਾਰੋਬਾਰ ਜੀਐਸਟੀ ਸੀਮਾ ਦੇ ਅਧੀਨ ਆਉਂਦਾ ਹੈ ਜਾਂ ਨਹੀਂ ਜੀਐਸਟੀ ਸਬੰਧੀ ਮੇਰੇ ਦਿਮਾਗ ਵਿੱਚ ਬਹੁਤ ਸਾਰੀਆਂ ਉਲਝਣਾਂ ਹਨ ਜਿਵੇਂ ਕਿ ਜੀਐਸਟੀ ਨੰਬਰ ਕਿੱਥੋਂ ਪ੍ਰਾਪਤ ਹੋਵੇਗਾ ਇਹ ਮੈਨੂੰ ਮੇਰੇ ਬਿੱਲ ਉੱਪਰ ਲੱਗੇ ਲੱਗ ਕੇ ਮਿਲੇਗਾ ਜਾਂ ਫੈਕਟਰੀ ਦੇ ਬਾਹਰ ਜੀਐਸਟੀ ਨੰਬਰ ਪ੍ਰਾਪਤ ਕਰਨ ਦੀ ਕੀ ਪ੍ਰਕਿਰਿਆ ਹੈ ਇਸ ਸੰਬੰਧੀ ਕਿਹੜੇ ਕਾਗਜ਼ ਪੱਤਰਾਂ ਦੀ ਲੋੜ ਹੈ ਜਿੱਦਾਂ ਕਿ ਮੇਰਾ ਕਾਰੋਬਾਰ ਛੋਟਾ ਹੈ ਤਾਂ ਕੀ ਇਸ ਲਈ ਜੀਐਸਟੀ ਦੀ ਜ਼ਰੂਰਤ ਹੈ ਜਾਂ ਨਹੀਂ ਜੇਕਰ ਮੈਂ ਆਪਣਾ ਕਾਰੋਬਾਰ ਬਿਨਾਂ ਜੀਐਸਟੀ ਤੋਂ ਚਲਾਵਾਂਗਾ ਤਾਂ ਕੀ ਮੈਨੂੰ ਕੋਈ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਾਂ ਨਹੀਂ ਜੇਕਰ ਭਵਿੱਖ ਵਿੱਚ ਮੈਂ ਆਪਣਾ ਕਾਰੋਬਾਰ ਵਧਾ ਲਵਾਂ ਤਾਂ ਕੀ ਮੈਨੂੰ ਜੀਐਸਟੀ ਨੰਬਰ ਨਵਾਂ ਲੈਣਾ ਪਵੇਗਾ ਜਾਂ ਉਸ ਸਮੇਂ ਜੀਐਸਟੀ ਸੰਬੰਧੀ ਕਿਹੜੀਆਂ ਤਬਦੀਲੀਆਂ ਆਉਣਗੀਆਂ ਮੈਨੂੰ ਕਾਰੋਬਾਰ ਸੰਬੰਧੀ ਕਿੰਨਾ ਜੀਐਸਟੀ ਦੇਣਾ ਪਵੇਗਾ